ਹਾਂ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਮੇੇਰੇ ਬਾਇਕਿੰਗ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਮੈਨੂੰ ਘੁੰਮਣ ਦਾ ਬਹੁਤ ਸ਼ੌਂਕ ਹੈ ਅਤੇ ਬਾਈਕ ਚਲਾਉਣ ਦਾ ਮੈਂ ਬਾਈਕ ਦੇ ਨਾਲ ਕਾਫੀ ਸਥਾਨਾਂ 'ਤੇ ਆਉਂਦੀ ਜਾਂਦੀ ਸੀਗੀ ਪਰ ਹੁਣ ਕਿਤੇ ਨਾ ਕਿਤੇ ਪੈਟਰੋਲ ਦੇ ਵੱਧ ਰਹੇ ਕੀਮਤਾਂ ਨੇ ਮੇਰੀ ਜੇਬ 'ਤੇ ਅਸਰ ਪਾਇਆ ਹੈ ਪਰ ਪੈਟਰੋਲ ਆਦਿ ਦਾ ਦਾ ਧੂੰਆਂ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਰਾਹੀਂ ਵਾਤਾਵਰਨ 'ਚ ਕਾਰਬਨ ਡਾਇਆਕਸਾਈਡ ਹਵਾ ਕਾਰਬਨ ਡਾਇਆਕਸਾਈਡ ਗੈਸ ਫੈਲ ਰਹੀ ਹੈ ਹਵਾ ਵਿੱਚ ਮਿਲ ਰਹੀ ਹੈ ਜ ਜਿਸ ਨਾਲ ਸਾਹ ਸੰਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਕਈ ਪ੍ਰਕਾਰ ਦੀਆਂ ਬਿਮਾਰੀਆਂ ਜਿਨ੍ਹਾਂ ਦਾ ਅਜੇ ਹੱਲ ਵੀ ਨਹੀਂ ਲੱਭਿਆ ਗਿਆ ਇਹ ਜਿਹੀਆਂ ਬਿਮਾਰੀਆਂ ਵੀ ਦੇਖਣ ਵਿੱਚ ਮਿਲ ਰਹੀਆਂ ਹਨ ਅਤੇ ਸਾਡੇ ਇਹ ਵਾਤਾਵਰਨ ਵਿੱਚ ਗਲੋਬਲ ਵਾਰਮਿੰਗ ਦੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜਿਸ ਰਾਹੀਂ ਹੜ੍ਹ ਆਉਣ ਦੀ ਸਮੱਸਿਆ ਪੈਦਾ ਹੋ ਰਹੀਆਂ ਹਨ ਜੋ ਕਿ ਸਾਡੇ ਆਉਣ ਵਾਲੇ ਭਵਿੱਖ ਲਈ ਬਹੁਤ ਹੀ ਬੁਰਾ ਸੰਦੇਸ਼ ਹੈ ਬੁਰੀ ਖਬਰ ਹੈ